ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਕੋਈ ਆਪਣੇ ਮਨਪਸੰਦ ਕਿਤਾਬ ਬਾਰੇ ਜਿਹੜੀ ਕਿ ਘਟਨਾ ਸੱਚੀ ਤੇ ਅਧਾਰ 'ਤੇ ਹੋਵੇ ਉਹਦੇ ਨਾਲ ਵਿਚਾਰ ਸਾਂਝੇ ਕਰਾਂਗੀ ਵੈਸੇ ਤਾਂ ਸਾਹਿਤਕਾਰਾਂ ਨੇ ਬਹੁਤ ਹੀ ਕਹਾਣੀਆਂ ਲਿਖੀਆਂ ਹਨ ਜੋ ਕਿ ਸੱਚੀਆਂ ਘਟਨਾ ਦੇ ਆਧਾਰ 'ਤੇ ਹਨ ਅਤੇ ਉਹਨਾਂ ਨੇ ਪੂਰੇ ਵੇਰਵੇ ਸਾਹਿਤ ਇਹਨਾਂ ਨੂੰ ਬਿਆਨ ਕੀਤਾ ਹੈ ਅੱਜ ਮੈਨੂੰ ਇੱਕ ਕਹਾਣੀ ਦਾ ਯਾਦ ਆਇਆ ਹੈ ਉਹ ਕਹਾਣੀ ਸੀ ਨਾਨਕ ਸਿੰਘ ਦੀ ਮਤਰੇਈ ਮਾਂ ਕਹਾਣੀ ਮਤਰੇਈ ਮਾਂ ਕਿਤਾਬ ਨਾਨਕ ਸਿੰਘ ਨੇ ਵੈਸੇ ਕਹਾਣੀਆਂ ਸਾਰੀਆਂ ਬੜੀਆਂ ਵਧੀਆ ਹੁੰਦੀਆਂ ਨੇ ਜਿਵੇਂ ਗਰੀਬ ਦੀ ਦੁਨੀਆਂ ਉਹ ਵੀ ਬਹੁਤ ਹੀ ਵਧੀਆ ਕਿਤਾਬ ਸੀ ਮਤਰੇਈ ਮਾਂ ਸ਼ਬਦ ਮਾਂ ਜਦੋਂ ਕਿਹਾ ਜਾਂਦਾ ਹੈ ਮਾਂ ਤੋਂ ਉੱਚਾ ਸ਼ਬਦ ਅਤੇ ਸੁੱਚਾ ਸ਼ਬਦ ਸ਼ਾਇਦ ਕੋਈ ਨਹੀਂ ਹੁੰਦਾ ਮਾਂ ਜਗ ਜਨਣੀ ਹੈ ਮਾਂ ਨੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ ਹੈ ਮਾਂ ਨੂੰ ਇਸ ਕਰਕੇ ਪਵਿੱਤਰ ਜਾਣਿਆ ਜ ਗਿਆ ਹੈ ਜਦੋਂ ਮਾਂ ਦੇ ਨਾਲ ਮਤਰੇਈ ਸ਼ਬਦ ਲੱਗ ਜਾਂਦਾ ਹੈ ਤਾਂ ਉਹ ਇੱਕ ਆਪਣਾ ਕੋਝਾ ਰੂਪ ਵਿਖਾ ਦਿੰਦਾ ਹੈ ਮਤਰੇਈ ਮਾਂ ਕਈ ਵਾਰ ਮਤਰੇਈਆਂ ਮਾਵਾਂ ਤਾਂ ਆਪਣੇ ਬੱਚਿਆਂ ਨੂੰ ਸਤ ਮਤਰਏ ਬੱਚਿਆਂ ਨੂੰ ਮਤਰੇਈਆਂ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਬੱਚਿਆਂ ਨੂੰ ਸਕੀਆਂ ਮਾਵਾਂ ਜਿੰਨਾਂ ਪਿਆਰ ਦਿੰਦੀਆਂ ਹਨ ਜੋ ਉਹਨਾਂ ਨੂੰ ਉਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ ਹੁੰਦਾ ਪਰ ਮਤਰੇਈ ਮਾਂ ਸ਼ਬਦ ਉਸ ਵੇਲੇ ਵਰਤਿਆ ਗਿਆ ਜਦੋਂ ਉਸ ਮਤਰੇਈ ਮਾਂ ਨੇ ਉਹਨਾਂ ਬੱਚਿਆਂ ਨੂੰ ਸਕੀ ਮਾਂ ਵਾਲਾ ਪਿਆਰ ਨਾ ਦਿੱਤਾ ਜੋ ਕਿ ਉਸ ਨੂੰ ਦੇਣਾ ਚਾਹੀਦਾ ਸੀ ਉਹ ਕਹਾਣੀ ਬਹੁਤ ਹੀ ਵਧੀਆ ਅਤੇ ਦਿਲਚਸਪ ਸੀ ਬਹੁਤ ਹੀ ਵਧੀਆ ਕਹਾਣੀ ਸੀ ਉਸ ਵਿੱਚ ਉਸ ਬੱਚੇ ਨਾਲ ਜਿਹੜਾ ਕਿ ਆਪਣੀ ਮਾਂ ਗਵਾ ਚੁੱਕਾ ਸੀ ਅਤੇ ਉਸਦੇ ਪਿਓ ਨੂੰ ਮਜਬੂਰਨ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਖਾਤਰ ਦੂਜਾ ਵਿਆਹ ਕਰਵਾਉਣਾ ਪਿਆ ਉਹ ਮਤਰੇਈ ਮਾਂ ਨੇ ਉਹਨਾਂ ਬੱਚਿਆਂ ਨਾ ਕਿਹੋ ਜਿਹਾ ਸਲੂਕ ਕੀਤਾ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਔਖਾ ਸੀ ਉਹ ਬੱਚੇ ਜੋ ਕਿ ਆਪਣੀ ਮਤਰੇਈ ਮਾਂ ਦਾ ਹਰ ਤਰ੍ਹਾਂ ਦਾ ਦੁੱਖ ਅਤੇ ਕਸ਼ਟ ਸਹਿ ਰਹੇ ਸਨ ਹਰ ਤਰ੍ਹਾਂ ਦੀਆਂ ਝਿੜਕਾਂ ਸਹਿ ਰਹੇ ਸਨ ਸਾਰਾ ਘਰ ਦਾ ਕੰਮ ਵੀ ਕਰ ਰਹੇ ਸਨ ਪਰ ਉਹ ਮਤਰੇਈ ਮਾਂ ਉਹਨਾਂ ਬੱਚਿਆਂ 'ਤੇ ਰੱਤਾ ਵੀ ਬਿਲਕੁਲ ਵੀ ਤਰਸ ਨਹੀਂ ਆ ਰਿਹਾ ਸੀ ਕੀ ਮਤਰੇਈ ਮਾਵਾਂ ਅਜਿਹੀਆਂ ਹੁੰਦੀਆਂ ਹਨ ਮੈਨੂੰ ਵਾਰ ਵਾਰ ਇਹ ਸੋਚਣ ਲਈ ਮਜਬੂਰ ਕਰ ਰਹੀਆਂ ਸਨ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ ਫਿਰ ਉਹ ਮਤਰੇਈ ਮਾਂ ਕਿਉਂ ਬਣ ਜਾਂਦੀ ਹੈ ਧੰਨਵਾਦ